ਵੈਸੇ ਤਾਂ ਸਾਡੇ ਵਿ ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਯਿਲਡਿੰਗ ਫਸਲਾਂ ਹਨ ਜਿਹਨਾਂ ਤੋਂ ਅਸੀਂ ਬਹੁਤ ਲਾਭ ਪ੍ਰਾਪਤ ਕਰਦੇ ਹਾਂ ਪਰ ਜੋ ਸਭ ਤੋਂ ਵਧੀਆ ਯਿਲਡਿੰਗ ਫਸਲ ਹੈ ਉਹ ਕਣਕ ਦੀ ਹੈ ਕਣਕ ਦੀ ਫਸਲ ਤੋਂ ਸਾਨੂੰ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ ਅਸੀਂ ਕਣਕ ਦੀ ਫਸਲ ਨੂੰ ਸਿਰਫ ਦੇਸੀ ਖਾਦ ਪਾਉਂਦੇ ਹਨ ਇਸ 'ਤੇ ਅਸੀਂ ਕੋਈ ਰੇਅ ਸਪਰੇਅ ਵੀ ਨਹੀਂ ਕਰਦੇ ਕਿਉਂਕਿ ਇਸ ਦੇ ਨਾਲ ਸਾਡੀ ਫਸਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਹੀ ਕਣਕ ਅਸੀਂ ਖਾਵਾਂਗੇ ਤਾਂ ਉਹ ਸਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਵੇਗੀ ਇਸ ਕਰਕੇ ਕਣਕ ਦੀ ਫਸਲ ਤੋਂ ਸਾਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ ਅਤੇ ਇਸ ਦੇ ਨਾਲ ਅਸੀਂ ਬਹੁਤ ਫਾਇਦੇਮੰਦ ਰਹਿੰਦੇ ਹਾਂ